ਸਤਿ ਸ਼੍ਰੀ ਅਕਾਲ ਮੈਮ ਹਾਂਜੀ ਤੁਸੀਂ ਹਰਿਕ੍ਰਿਸ਼ਨ ਸਕੂਲ ਤੋਂ ਬੋਲਦੇ ਪਏ ਨਾ ਹਾਂਜੀ ਮੈਮ ਸਾਡੀ ਨਾ ਬੇਟੀ ਸਮਲੀਨ ਕੌਰ ਆ ਸੈਵਨਥ ਕਲਾਸ 'ਚ ਪੜ੍ਹਦੀ ਉਹਦੇ ਲਈ ਛੁੱਟੀ ਚਾਹੀਦੀ ਸੀ ਸਾਨੂੰ ਦਸ ਦਿਨ ਦੀ ਜੀ ਮੈਮ ਜ਼ਰੂਰੀ ਚਾਹੀਦੀ ਸੀਗੀ ਹਾਂਜੀ ਮੈਮ ਇਹ ਤਾਂ ਹੈਗ ਇਹ ਤਾਂ ਹੈ ਹੀ ਆ ਮੈਮ ਪਰ ਸਾਨੂੰ ਨਾ ਵਿਆਹ ਸੀਗਾ ਇਸ ਤਰ੍ਹਾਂ ਜ਼ਰੂਰੀ ਜਾਣਾ ਵਾ ਦਸ ਦਿਨ ਵਾਸਤੇ ਛੁੱਟੀ ਚਾਹੀਦੀ ਆ ਤੁਸੀਂ ਦੇ ਦਿਉ ਤਾਂ ਚੰਗੀ ਗੱਲ ਆ ਕਿਉਂਕਿ ਬਾਅਦ 'ਚ ਅਸੀਂ ਬੱਚੇ ਵੱਲ ਥੋੜ੍ਹਾ ਜ਼ਿਆਦਾ ਧਿਆਨ ਦੇ ਲਾਂਗੇ ਕਿ ਅਸੀਂ ਨਾ ਛੁੱਟੀ ਕਰਾਵਾਂਗੇ ਪੈਂਡਿੰਗ ਕੰਮ ਵੀ ਪੂਰਾ ਹੋਜੂ ਕਰਾ ਲਾਂਗੇ ਇਹਨਾਂ ਦਾ ਅਤੇ ਪਰ ਤੁਸੀਂ ਹੁਣ ਇਹ ਆ ਕਿ ਸਾਨੂੰ ਛੁੱਟੀ ਦੇ ਦਿਉ ਦਸ ਦੀ ਨਹੀਂ ਤਾਂ ਤੁਸੀਂ ਸੱਤ ਦਿਨ ਦੀ ਦੇ ਦਿਉ ਜ਼ਰੂਰੀ ਚਾਹੀਦੀ ਹੈ ਠੀਕ ਹੈ ਮੈਮ ਉਹ ਤਾਂ ਅਸੀਂ ਕਰਾਵਾਂਗੇ ਉਹ ਅਤੇ ਪਰ ਚੱਲੋ ਪਰ ਤੁਸੀਂ ਕਹਿਣਦੇ ਕਿ ਤੁਹਾਡਾ ਬੱਚਾ ਬਹੁਤ ਵੀਕ ਚੱਲਦਾ ਪਿਆ ਵਾ ਅਤੇ ਤੁਸੀਂ ਵੀ ਧਿਆਨ ਦਿਆ ਕਰੋ ਵੀ ਅਸੀਂ ਵੀ ਦਿੰਦੇ ਹਾਂ ਤੁਸੀਂ ਵੀ ਦਿਓ ਵੀ ਇਹ ਬੱਚਾ ਚਲੋ ਅੱਗੇ ਜਾ ਪਾਵੇ ਵਧੀਆ ਕਰ ਪਾਵੇ ਹਾਂਜੀ ਮੈਮ ਨਹੀਂ ਅਸੀਂ ਤਾਂ ਜਿਹੜਾ ਵੀ ਇਹਨੂੰ ਹੋਮਵਰਕ ਮਿਲਦਾ ਵਾ ਅਸੀਂ ਰੋਜ਼ ਡੇਲੀ ਕਰਵਾਉਂਦੇ ਹਾਂ ਇਨ੍ਹਾਂ ਨੂੰ ਆਪਣਾ ਕੋਲ ਬਿਠਾਉਂਦੇ ਵੀ ਹਾਂ ਟਾਇਮ ਵੀ ਲਗਵਾਉਂਦੇ ਹਾਂ ਪੜ੍ਹਾਉਣ ਵਾਸਤੇ ਘੜੀ ਬਿਠਾ ਕੇ ਨਹੀਂ ਅਸੀਂ ਤਾਂ ਆਪਣੇ ਵੱਲੋਂ ਪੂਰੀ ਖੇਚਲ ਕਰਾਂਣਡੇ ਹਾਂ ਹੁਣ ਤੁਸੀਂ ਵੀ ਕਰੋ